ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੇਜਪਾਲ ਬੋਲ ਰਹੇ ਹੋ ਜੀ ਮੈਂ ਆਪਣੇ ਭਰਾ ਤੋਂ ਨੰਬਰ ਲਿਆ ਸੀ ਤੁਹਾਡਾ ਅਤੇ ਮੈਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਘੁੰਮਣਾ ਚਾਹੁੰਦੀ ਹਾਂ ਹਾਂਜੀ ਮੈਂ ਹੀ ਕੱਲ੍ਹ ਪਰਸੋਂ ਤੱਕ ਆਉਣਾ ਚਾਹੁੰਦੀ ਹਾਂ ਜੀ ਅਤੇ ਮੈਂ ਇੱਥੇ ਜੋ ਵੀ ਮਤਲਬ ਇਤਿਹਾਸਿਕ ਜਗ੍ਹਾ ਆ ਮੈਂ ਇੱਥੇ ਘੁੰਮਣਾ ਚਾਹੁੰਦੀ ਹਾਂ ਅਤੇ ਤੁਸੀਂ ਮੈਨੂੰ ਕੁਝ ਦੱਸ ਸਕਦੇ ਓਂ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਫਿਰ ਤਾਂ ਅਸੀਂ ਮਤਲਬ ਭੀੜ ਤੋਂ ਬਾਅਦ ਆ ਜਾਂਗੇ ਜੀ ਜਦੋਂ ਭੀੜ ਘੱਟ ਹਾਂਜੀ

ਕੋਈ ਨਹੀਂ ਓਕੇ ਠੀਕ ਹੈ ਥੈਂਕ ਯੂ ਜੀ ਠੀਕ ਹੈ ਠੀਕ ਹੈ